ਮੈਨੂੰ ਸ਼ੁਰੂ ਤੋਂ ਹੀ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਰਿਹਾ ਹੈ ਮੈਂ ਛੋਟੇ ਹੁੰਦੇ ਤੋਂ ਹੀ ਫੋਟੋ ਵਗੈਰਾ ਖਿੱਚਣਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਮੇਰੇ ਸਮੇਂ 'ਤੇ ਇੰਨੇ ਸਮਾਰਟਫੋਨ ਨਹੀਂ ਸੀਗੇ ਪਰ ਮੇਰੇ ਪਿਤਾ ਜੀ ਕੋਲ ਇੱਕ ਕੈਮਰਾ ਹੁੰਦਾ ਸੀ ਕਿਉਂਕਿ ਮੇਰੇ ਪਿਤਾ ਜੀ ਨੂੰ ਵੀ ਸ਼ੁਰੂ ਤੋਂ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕ ਰਿਹਾ ਹੈ ਉਹਨਾਂ ਨੇ ਸਪੈਸ਼ਲ ਵਿਦੇਸ਼ੋਂ ਕੈਮਰਾ ਮੰਗਵਾਇਆ ਸੀ ਅਤੇ ਉਹ ਉਹ ਵੀ ਬਹੁਤ ਚੰਗੀ ਚੰਗੀ ਫੋਟੋ ਫੋਟੋਗ੍ਰਾਫੀ ਕਰਦੇ ਸੀ ਬਹੁਤ ਚੰਗੀਆਂ ਚੰਗੀਆਂ ਫੋਟੋ ਖਿੱਚਦੇ ਸੀਗੇ ਅਤੇ ਮੈਨੂੰ ਵੀ ਜਿਵੇਂ ਕੁਦਰਤ ਮੈਨੂੰ ਜ਼ਿਆਦਾਤਰ ਕੁਦਰਤ ਦੀ ਫੋਟੋ ਖਿੱਚਣਾ ਬਹੁਤ ਪਸੰਦ ਸੀ ਮੈਂ ਵੀ ਉਹਨਾਂ ਦੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਸੀ ਮੈਂ ਅਤੇ ਮੈਂ ਵੀ ਫਿਰ ਉਹਨਾਂ ਦੇ ਕੈਮਰੇ ਕੈਮਰੇ 'ਚ ਕੈਮਰੇ 'ਚ ਬਹੁਤ ਅੱਛੇ ਅੱਛੇ ਫੋਟੋ ਖਿੱਚਣ ਦੀ ਕੋਸ਼ਿਸ਼ ਕਰਦੀ ਸੀ ਅਤੇ ਮੈਂ ਮੈਨੂੰ ਫੋਟੋਗ੍ਰਾਫੀ ਦਾ ਇੰਨਾ ਕੁ ਸ਼ੌਕ ਹੋ ਗਿਆ ਮੈਨੂੰ ਇੰਨੀ ਕੁ ਵਧੀਆ ਲੱਗਣ ਲੱਗੀ ਇਹ ਚੀਜ਼ ਮੈਂ ਮੈਂ ਸੋਚਿਆ ਕਿ ਮੈਂ ਇਸ ਨੂੰ ਆਪਣੇ ਇੱਕ ਪੇਸ਼ੇ ਵਿੱਚ ਲਵਾਂ ਇਹਨੂੰ ਇਸਨੂੰ ਆਪਣਾ ਇੱਕ ਪੇਸ਼ਾ ਬਣਾਵਾਂ ਇੱਕ ਪ੍ਰੋਫੈਸ਼ਨ ਬਣਾਵਾਂ ਇਹਨੂੰ ਪਰ ਹਾਲਾਂਕਿ ਜਿਵੇਂ ਹੁਣ ਲੋਕ ਕਹਿੰਦੇ ਆ ਕਿ ਕੁੜੀਆਂ ਦਾ ਫੋਟੋਗ੍ਰਾਫੀ ਵਿੱਚ ਕੋਈ ਭਵਿੱਖ ਨਹੀਂ ਹੈ ਇੱਕ ਸਾਡਾ ਸ਼ਹਿਰ ਇੱਥੇ ਛੋਟਾ ਤਾਂ ਇੱਥੇ ਕੋਈ ਵਰਕਸ਼ਾਪਸ ਵੀ ਨਹੀਂ ਹੈਗੀਆਂ ਅਤੇ ਜਿਵੇਂ ਲੋਕ ਕਹਿੰਦੇ ਆ ਨਾ ਕਿ ਮਤਲਬ ਕੁੜੀਆਂ ਦਾ ਕੋਈ ਭਵਿੱਖ ਹੀ ਨਹੀਂ ਹੈਗਾ ਫੋਟੋਗ੍ਰਾਫੀ ਵਿੱਚ ਪਰ ਇਸ ਮਾਮਲੇ ਵਿੱਚ ਮੇਰੇ ਘਰਦਿਆਂ ਦੀ ਸੋਚ ਬਹੁਤ ਵਧੀਆ ਲੱਗੀ ਮੈਨੂੰ ਮੇਰੇ ਘਰਦਿਆਂ ਨੇ ਮੈਨੂੰ ਕਦੇ ਵੀ ਮੇਰੇ ਘਰਦਿਆਂ ਨੇ ਕਦੇ ਵੀ ਮੇਰੇ 'ਤੇ ਰੋਕ ਟੋਕ ਨਹੀਂ ਕੀਤੀ ਮਤਲਬ ਜੋ ਚੀਜ਼ ਜੋ ਸ਼ੌਕ ਹੈ ਉਹ ਪੂਰਾ ਮਤਲਬ ਪੂਰਾ ਕਰਨ ਲਈ ਮੈਨੂੰ ਬਹੁਤ ਸਪੋਟ ਕੀਤਾ ਉਹਨਾਂ ਨੇ ਅਤੇ ਜਿਵੇਂ ਇੱਧਰ ਵ ਵਰਕਸੋਪਸ ਵਗੈਰਾ ਹੈ ਨਹੀਂ ਪਰ ਫਿਰ ਵੀ ਜਿਵੇਂ ਸਾਡੇ ਗੁਆਂਢੀਆਂ ਕੋਲ ਮਤਲਬ ਸਾਡੇ ਗੁਆਂਢੀ ਹੈਗੇ ਉਹ ਵੀ ਇੱਕ ਫੋਟੋਗ੍ਰਾਫਰ ਹੈ ਮੈਂ ਉਨ ਉਹਨਾਂ ਕੋਲ ਜਾਂਦੀ ਹੁੰਦੀ ਸੀ ਮੈਂ ਉਹਨਾਂ ਜਿਵੇਂ ਮੈਂ ਆਪਣੇ ਪਿਤਾ ਜੀ ਤੋਂ ਤਾਂ ਪੁੱਛਦੀ ਪੁੱਛਦੀ ਸੀਗੀ ਕਿ ਕੀ ਕੀ ਕਰਨਾ ਚਾਹੀਦਾ ਪਰ ਮੈਂ ਉਹਨਾਂ ਜਿਹੜੇ ਗੁਆਂਢੀ ਸੀਗੇ ਉਹ ਵੀ ਹੁਣ ਜਿਵੇਂ ਉਹਨਾਂ ਨਾਲ ਪ੍ਰੋਫੈਸ਼ਨ ਹੀ ਸੀਗਾ ਇਹ ਅਤੇ ਮੈਂ ਉਹਨਾਂ ਤੋਂ ਪੁੱਛਦੀ ਹੁੰਦੀ ਸੀ ਕਿ ਮਤਲਬ ਕਿ ਕਿਵੇਂ ਕਿਵੇਂ ਫੋਟੋਜ਼ ਵਗੈਰਾ ਖਿੱਚਣੀਆਂ ਚਾਹੀਦੀਆਂ ਇਸ ਬਾਰੇ ਮੈਂ ਇਸ ਬਾਰੇ ਮੈਂ ਪੂਰੀ ਜਾਣਕਾਰੀ ਲੈਂਦੀ ਹੁੰਦੀ ਸੀ ਕਿਉਂਕਿ ਮੈਂ ਇਸ ਨੂੰ ਆਪਣਾ ਇੱਕ ਪੇਸ਼ਾ ਬਣਾਉਣਾ ਚਾਹੁੰਦੀ ਸੀ ਅਤੇ ਮੈਨੂੰ ਐਹ ਇੱਦਾਂ ਲੱਗਦਾ ਸੀ ਕਿ ਮੈਂ ਇਸ ਕੰਮ ਵਿੱਚ ਬਿਲਕੁਲ ਪਰਫੈਕਟ ਹੋਜਾਂ ਮੈਂ ਬਹੁਤ ਕੁਛ ਪੁੱਛਦੀ ਰਹਿੰਦੀ ਸੀ ਅਤੇ ਜਿਵੇਂ ਮੇਰੇ ਕੋਲਜ ਵਿੱਚ ਵੀ ਬਹੁਤ ਫੰਕਸ਼ਨਸ ਵਗੈਰਾ ਹੁੰ ਮਤਲਬ ਫੰਕਸ਼ਨ ਨਹੀਂ ਕੋਂਪੀਟੀਸ਼ਨ ਹੁੰਦੇ ਸੀਗੇ ਅਤੇ ਫੋਟੋਗ੍ਰਾਫੀ ਦੇ ਇੱਕ ਕੰਪਟੀਸ਼ਨ ਆਇਆ ਸੀਗਾ ਅਤੇ ਮੈਂ ਉਹਦੇ ਵਿੱਚ ਹਿੱਸਾ ਲਿੱਤਾ ਸੀ ਅਤੇ ਮਤਲਬ ਮੈਨੂੰ ਚੰਗਾ ਲੱਗਿਆ ਉਹ ਕੰਪੀਟੀਸ਼ਨ ਕਰਕੇ ਉਹ 'ਚ ਹਾਲਾਂ ਚਾਹੇ ਮੈਨੂੰ ਇਨਾਮ ਦਾ ਨਹੀਂ ਸੀਗਾ ਕੁਛ ਪਰ ਮੈਂ ਇੱਦਾਂ ਸੀ ਕਿ ਮੇਰਾ ਸ਼ੌਕ ਸੀਗਾ ਨਾ ਫੋਟੋਗ੍ਰਾਫੀ ਕਰਨ ਦਾ ਤਾਂ ਮੈਨੂੰ ਇੱਦਾਂ ਲੱਗਿਆ ਕਿ ਮੈਨੂੰ ਹਿੱਸਾ ਲੈਣਾ ਚਾਹੀਦਾ ਹੈ ਚਾਹੇ ਗਲਤ ਆਏ ਚਾਹੇ ਜੋ ਮਰਜ਼ੀ ਹੋਵੇ ਮਤਲਬ ਬੰਦੇ ਨੂੰ ਆਪਣਾ ਕੋਨਫੀਡੈਂਸ ਨਹੀਂ ਲੂਜ ਕਰਨਾ ਚਾਹੀਦਾ ਆਪਣੇ ਸ਼ੌਕ ਨੂੰ ਮਤਲਬ ਅੱਗੇ ਵਧਾਉਣਾ ਚਾਹੀਦਾ ਹੈ ਆਪਣੇ ਸ਼ੌਕ ਨੂੰ ਉਸ ਵਿੱਚ ਕੰਮ ਕਰੇ ਅਤੇ ਮੈਂ ਉਸ ਵਿੱਚ ਹਿੱਸਾ ਲਿੱਤਾ ਸੀ ਮੈਨੂੰ ਅੱਛਾ ਲੱਗਿਆ ਉਹ ਕਰਕੇ ਅਤੇ ਹੋਰ ਸਾਡਾ ਸ਼ਹਿਰ ਛੋਟਾ ਹੋਣ ਕਰਕੇ ਇੱਥੇ ਵਰਕਸ਼ੋਪਸ ਵਗੈਰਾ ਵੀ ਘੱਟ ਸੀਗੀਆਂ ਤਾਂ ਜੋ ਇੰਨੀ ਕੁ ਮੈਨੂੰ ਜਾਣਕਾਰੀ ਮਿਲੀ ਨਹੀਂ ਵੈਸੇ ਪਰ ਮੈਂ ਜਿਵੇਂ ਸ਼ੋਸ਼ਲ ਮੀਡੀਆ ਦਾ ਪਲੈਟਫੋਮ ਬਹੁਤ ਹੈਗਾ ਹੁਣ ਤਾਂ ਹੁਣ ਦੇ ਜ਼ਮਾਨੇ ਮਤਲਬ ਹੁਣ ਜਦੋਂ ਇਹ ਸਮਾਰਟਫੋਨ ਵਗੈਰਾ ਆ ਗਏ ਨੇ ਅਤੇ ਉਦੋਂ ਮੈਂ ਯੂਟਿਊਬ ਵਗੈਰਾ 'ਤੇ ਵੀ ਜਿਵੇਂ ਬਹੁਤ ਵੇਖ ਵੇਖਦੀ ਸੀਗੀ ਵੀਡੀਓਜ ਅਤੇ ਮੈਂ ਉੱਥੋਂ ਵੀ ਬਹੁਤ ਕੁਛ ਸਿੱਖਿਆ ਅਤੇ ਮੇਰਾ ਇਹ ਫੋਟੋਗ੍ਰਾਫੀ ਸਿੱਖਣ ਦਾ ਜੋ ਸੀ ਮਤਲਬ ਮੈਨੂੰ ਬਹੁਤ ਚੰਗਾ ਮੈਨੂੰ ਬਹੁਤ ਚੰਗਾ ਲੱਗਦਾ ਸੀ ਇਸ ਬਾਰੇ ਅਤੇ ਬਸ ਮੈਨੂੰ ਬਹੁਤ ਚੰਗੀ ਲੱਗੀ ਇਹ ਫੋਟੋਗ੍ਰਾਫੀ ਵਾਲੀ ਚੀਜ਼ ਧੰਨਵਾਦ